ਸਰਕਾਰੀ ਸਕੀਮਾਂ ਵਿੱਚੋਂ ਕੁਝ ਕੁ ਸਕੀਮਾਂ ਦਾ ਮੈਂ ਲਾਭ ਲੈ ਰਹੀ ਹਾਂ ਜਿਵੇਂ ਕਿ ਆਟਾ ਦਾਲ ਸਕੀਮ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਸਕੀਮ ਮੈਨੂੰ ਇਹਨਾਂ ਦੋਹਾਂ ਸਕੀਮਾਂ ਦਾ ਬਹੁਤ ਲਾਭ ਹੋਇਆ ਕਿਉਂਕਿ ਆਟਾ ਦਾਲ ਸਕੀਮ ਦੇ ਤਹਿਤ ਮਿਲਦੀ ਕਣਕ ਨਾਲ ਰੋਟੀ ਦਾ ਫਿਕਰ ਘੱਟ ਜਾਂਦਾ ਹੈ ਅਤੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਤਹਿਤ ਮੈਂ ਉੱਚ ਸਿੱਖਿਆ ਆਸਾਨੀ ਨਾਲ ਪ੍ਰਾਪਤ ਕਰ ਸਕਦੀ ਹਾਂ